ਅਸੀਂ ਸਾਰਿਆਂ ਨਾਲ ਖਾਣ ਪੀਣ ਦਾ ਆਨੰਦ ਬਹੁਤ ਮਾਣਦੇ ਹਾਂ ਅਜਿਹੇ ਬਹੁਤ ਸਾਰੇ ਮੌਕੇ ਹਨ ਜਿਹਨਾਂ 'ਤੇ ਅਸੀਂ ਲੰਚ ਡਿਨਰ ਜਾਂ ਫਿਰ ਹੋਰ ਵੀ ਪਾਰਟੀ ਦੀ ਇਨਵਾਈਟ ਕਰਦੇ ਹਾਂ ਸੱਦਾ ਦਿੰਦੇ ਹਾਂ ਅਸੀਂ ਜਿਵੇਂ ਬਰਥਡੇ ਬਾਡੇ ਹੋ ਗਿਆ ਕਿਸੇ ਦਾ ਜਾਂ ਵਿਆਹ ਹੋ ਗਿਆ ਅਤੇ ਇੱਕ ਹੋਰ ਵੀ ਬਹੁਤ ਸਾਡੇ ਜਿਵੇਂ ਗੁਰਪੁਰਬ ਮਨਾਇਆ ਜਾਂਦਾ ਹੈ ਚਲੋ ਉਹ ਤਾਂ ਇੱਕ ਤਰ੍ਹਾਂ ਦਾ ਲੰਗਰ ਹੋ ਗਿਆ ਪ੍ਰਭਾਤ ਫੇਰੀਆਂ ਵੇਲੇ ਹਰ ਕੋਈ ਗੁਰਦੁਆਰਾ ਸਾਹਿਬ ਜਾਂ ਆਪਣੇ ਘਰਾਂ ਵਿੱਚ ਸ਼ਰਧਾ ਅਨੁਸਾਰ ਲੰਗਰ ਲਾਉਂਦਾ ਏ ਅਤੇ ਆਪਾਂ ਉਸ ਵਿੱਚ ਇਕੱਠੇ ਬੈਠ ਕੇ ਛਕਦੇ ਹਾਂ ਅਤੇ ਹੋਰ ਵਿਆਹ ਹੋ ਗਿਆ ਉੱਥੇ ਵੀ ਆਪਾਂ ਜਦੋਂ ਫੈਮਲੀ ਨਾਲ ਜਾਂਦੇ ਹਾਂ ਜਾਂ ਹੋਰ ਰਲੇਟਿਵਸ ਆਉਂਦੇ ਨੇ ਉਹਨਾਂ ਨਾਲ ਇਕੱਠੇ ਬਹਿ ਕੇ ਲੰਚ ਡਿਨਰ ਇੰਜੋਏ ਕਰਦੇ ਹਾਂ ਅਜਿਹੇ ਬਹੁਤ ਸਾਰੇ ਹੋਰ ਮੌਕੇ ਹਨ ਜਿਹਨਾਂ 'ਤੇ ਅਸੀਂ ਇਕੱਠੇ ਬੈਠ ਕੇ ਕਰ ਸਕਦੇ ਹਾਂ